ਮੈਂ ਸੁਨੀਲ ਕੁਮਾਰ ਮਿਰਜਾਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਔਰਤਾਂ ਦੀ ਦਸ਼ਾ ਬਹੁਤ ਬਦਲ ਚੁੱਕੀ ਹੈ ਅੱਜ ਕੱਲ੍ਹ ਔਰਤਾਂ ਪੜ੍ਹਾਈ ਦੇ ਖੇਤਰ ਵਿੱਚ ਬਹੁਤ ਅੱਗੇ ਹੈ ਬਹੁਤ ਜ਼ਿਆਦਾ ਅੱਗੇ ਹੈ ਜਿੱਥੇ ਅੱਜ ਕੱਲ੍ਹ ਬੰਦੇ ਕੰਮ ਕਰਦੇ ਸੀ ਉਸ ਦਫਤਰ ਵਿੱਚ ਅੱਜ ਕੱਲ੍ਹ ਵੱਧ ਤੋਂ ਵੱਧ ਔਰਤਾਂ ਵੱਧ ਚੜ੍ਹ ਕੇ ਕੰਮ ਕਰਦੀਆਂ ਹਨ ਅੱਜ ਕੱਲ੍ਹ ਦੀ ਔਰਤ ਬਹੁਤ ਅੱਗੇ ਪੁੱਜ ਚੁੱਕੀ ਹੈ ਉਦਾਹਰਣ ਤੌਰ 'ਤੇ ਰਾਸ਼ਟਰਪਤੀ ਭਾਰਤ ਦੀ ਵੀ ਇਕ ਔਰਤ ਸੀ ਆਈਏਐਸ ਪੀਸੀਐਸ ਵੱਡੇ ਅਹੁਦਿਆਂ 'ਤੇ ਅੱਜ ਕੱਲ੍ਹ ਔਰਤਾਂ ਹੀ ਹਨ ਅੱਜ ਕੱਲ੍ਹ ਹਰ ਦਫਤਰ ਹਰ ਕੰਮ ਵਿੱਚ ਬੈਂਕਾਂ ਵਿੱਚ ਦਫਤਰ ਵਿੱਚ ਰੇਲਵੇ ਸਕੂਲਾਂ ਦਫਤਰਾਂ ਵਿੱਚ ਰੇਲਵੇ 'ਚ ਸੁਵਿਧਾ ਕੇਂਦਰਾਂ ਵਿੱਚ ਔਰਤਾਂ ਹੀ ਕੰਮ ਕਰਦੀਆਂ ਹਨ ਹਰ ਅਦਾਰੇ ਵਿੱਚ ਘੁੰਡ ਘੁੰਡ ਕੱਢਣਾ ਪੁਰਾਣੇ ਰਿਵਾਜ਼ ਬਦਲ ਚੁੱਕੇ ਹੈ ਜਿਵੇਂ ਕਿ ਅੱਜ ਕੱਲ੍ਹ ਮੁਸਲਮਾਨਾਂ ਦੀਆਂ ਬਹੁ ਬੇਟੀਆਂ ਬੁਰਕਾ ਪਾ ਕੇ ਕੰਮ ਕਰਦੀਆਂ ਹਨ ਬਾਹਰ ਜਾਣਾ ਤਾਂ ਵੀ ਬੁਰਕਾ ਪਾ ਕੇ ਅਤੇ ਘਰ ਆਉਣਾ ਤਾਂ ਵੀ ਬੁਰਕਾ ਪਾ ਕੇ ਉਹ ਆਪਣਾ ਫੇਸ ਕਿਸੇ ਨੂੰ ਨਹੀਂ ਦਰਸਾਉਂਦੀਆਂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਔਰਤਾਂ ਅੱਜ ਦੇ ਸਮੇਂ 'ਚ ਸਭ ਨਾਲੋਂ ਅੱਗੇ ਪੁੱਜ ਚੁੱਕੀਆ ਹਨ ਧੰਨਵਾਦ ਜੀ